ਸਾਡੇ ਖੇਤਰ ਦੇ ਲੋਕ ਜ਼ਿਆਦਾਤਰ ਮਲਵਈ ਭਾਸ਼ਾ ਬੋਲਦੇ ਹਨ ਕੁਛ ਕੁ ਨਾਲ ਦੇ ਖੇਤਰ ਲੱਗ ਜਾਂਦੇ ਹਨ ਉਨ੍ਹਾਂ 'ਚ ਪੁਆਧੀ ਭਾਸ਼ਾ ਵੀ ਬੋਲੀ ਜਾਂਦੀ ਹੈ ਪਰ ਜ਼ਿਆਦਾਤਰ ਲੋਕ ਮਲਵਈ ਭਾਸ਼ਾ ਹੀ ਬੋਲਦੇ ਹਨ ਸੰਚਾਰ ਦੇ ਉਦੇਸ਼ਾਂ ਲਈ ਜੇ ਪੰਜਾਬ ਦੇ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਮਾਝੀ ਭਾਸ਼ਾ ਬੋਲੀ ਜਾਂਦੀ ਹੈ ਪਰ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ ਹੈ ਤਾਂ ਮਲਵਈ ਭਾਸ਼ਾ ਹੀ ਢੁੱਕਵੀਂ ਹੈ ਸਮਝਦਾਰ ਹੈ ਕਿਉਂਕਿ ਇਸ ਦਾ ਇਸਨੂੰ ਚੰਗੀ ਤਰ੍ਹਾਂ ਹੀ ਸਾਰੇ ਲੋਕ ਜਾਣਦੇ ਹਨ ਗੱਲਬਾਤ ਕਰਨ 'ਚ ਸੁਖਾਵਲੀ ਹੁੰਦੀ ਹੈ ਇਸ ਕਰਕੇ ਸੰਚਾਰ ਦੇ ਲਈ ਵੀ ਆਮ ਗੱਲਬਾਤ ਕਰਨ ਲਈ ਵੀ ਇਹ ਭਾਸ਼ਾ ਮਲਵਈ ਭਾਸ਼ਾ ਬੋਲੀ ਜਾਂਦੀ ਹੈ